ਅੱਜ ਕੱਲ੍ਹ ਬੱਚਿਆਂ ਨੂੰ ਆਪਣਾ ਬੱਚਤ ਖਾਤਾ ਬਣਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਭਵਿੱਖ ਕਿਸੇ ਨੂੰ ਪਤਾ ਨਹੀਂ ਹੁੰਦਾ ਇਸ ਲਈ ਭਵਿੱਖ ਤੋਂ ਨਿੜੀਖਣ ਲਈ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਬੱਚਤ ਖਾਤਾ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਭਵਿੱਖ ਕਿਸੇ ਦਾ ਸਾਂਝਾ ਨਹੀਂ ਹੁੰਦਾ ਭਵਿੱਖ ਤੋਂ ਬਚਣ ਲਈ ਜਾਂ ਭਵਿੱਖ ਵਲੋਂ ਤੋਂ ਹੋਣ ਵਾਲੀਆਂ ਆਫਤਾਂ ਤੋਂ ਬਚਣ ਲਈ ਸਾਨੂੰ ਬਚਤ ਖਾਤੇ ਦੀ ਲੋੜ ਪੈਂਦੀ ਹੈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅਤੇ ਬੱਚਿਆਂ ਦੇ ਹੋਰ ਰੁਝੇਵੇਂ ਕਾਰਨ ਬੱਚਾ ਆਪਣੇ ਆਪ ਨਿਰਭਰ ਹੋਣਾ ਚਾਹੀਦਾ ਹੈ ਬਚ ਪਿਤਾ ਅਤੇ ਮਾਤਾ ਗਰੀਬ ਹੋਣ ਦੇ ਕਾਰਨ ਬੱਚਿਆਂ ਨੂੰ ਬੱਚਤ ਵੱਲ ਜ਼ਿਆਦਾ ਪ੍ਰੇਰਿਤ ਕਰਨਾ ਚਾਹੀਦਾ ਹੈ ਹੈ ਐਡਮ ਸਮਿਥ ਇਕਨੋਮਿਕਸ ਨੇ ਵੀ ਬੱਚਤ ਦੀ ਮਹਾਨਤਾ ਨੂੰ ਪਰਿਭਾਸ਼ਾ ਦਿੱਤੀ ਹੈ ਬੱਚਤ ਸਾਨੂੰ ਸਾਡੀ ਜ਼ੰਦਗੀ ਵਿੱਚ ਹੋਣੀ ਚਾਹੀਦੀ ਹੈ ਅਤੇ ਖ ਜਿਸ ਨਾਲ ਖਰਚਿਆਂ ਤੋਂ ਨਜਿੱਠਣ ਲਈ ਬੱਚਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਬੱਚਿਆਂ ਨੂੰ ਬੱਚਤ ਖਾਤਾ ਬਣਾਉਣ ਲਈ ਸ ਉਤਸਾਹਿਤ ਕਰਨ ਦੀ ਲੋੜ ਚਾਹੀਦੀ ਹੈ ਬੱਚਤ ਖਾਤੇ ਤੋਂ ਬੱਚਤ ਖਾਤੇ ਤੋਂ ਲਈ ਬੱਚਤ ਖਾਤੇ ਲਈ ਸਾਨੂੰ ਸਭ ਤੋਂ ਪਹਿਲਾਂ ਆਪ ਬੱਚਤ ਕਰਨੀ ਪੈਂਦੀ ਹੈ ਅਤੇ ਫਿਰ ਹੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ ਕਿ ਬੱਚਤ ਕਿਵੇਂ ਕਰਨੀ ਚਾਹੀਦੀ ਹੈ ਬੱਚਤ ਖਾਤਾ ਬਣਾਉਣ ਲਈ ਅੱਜ ਕੱਲ੍ਹ ਆਨਲਾਈਨ ਪਲਲੈਟਫਾਰਮ ਬਹੁਤ ਜ਼ਿਆਦਾ ਬਣ ਚੁੱਕੇ ਹਨ ਅਤੇ ਜਿਸ ਨਾਲ ਬਹੁਤ ਸਾਰੇ ਬੱਚੇ ਲਾਭ ਵੀ ਉਠਾ ਰਹੇ ਹਨ ਅੱਜ ਕੱਲ੍ਹ ਦੇ ਬੱਚੇ ਬਹੁਤ ਜ਼ਿਆਦਾ ਹੁਸ਼ਿਆਰ ਹਨ ਜਿਸ ਵਜੋਂ ਉਹਨਾਂ ਨੂੰ ਬੱਚਤ ਖਾਤੇ ਦੀ ਪ੍ਰੇਰਿਤ ਜਾਣਕਾਰੀ ਮਿਲਦੀ ਜਾ ਰਹੀ ਹੈ ਅਤੇ ਉਹ ਬੱਚਤ ਖਾਤੇ ਖਾਤਾ ਬਣਾਉਣ ਲਈ ਉਤਸਾਹਿਤ ਹੁੰਦੇ ਜਾ ਰਹੇ ਹਨ ਇਸ ਲਈ ਸਾਨੂੰ ਬੱਚਤ ਲਈ ਬਹੁਤ ਜ਼ਿਆਦਾ ਬੱਚਤ ਲਈ ਬਹੁਤ ਜ਼ਿਆਦਾ ਬੱਚਤ ਜ ਬਹੁਤ ਜ਼ਿਆਦਾ ਲੋੜ ਬੱਚਤ ਪੈਂਦੀ ਹੈ ਬੱਚਤ ਖਾਤਾ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਨਿਭਾ ਦੇਵੇਗਾ ਜਿਸ ਲਈ ਸਾਨੂੰ ਬੱਚਤ ਖਾਤੇ ਨੂੰ ਬਣਾਉਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਬੱਚਤ ਸਾਡੀ ਜ਼ਿੰਦਗੀ ਵਿੱਚ ਕਿੰਨੀ ਕੁ ਜ਼ਰੂਰਤ ਹੈ ਬੱਚਤ ਲਈ ਸਾਨੂੰ ਸਭ ਤੋਂ ਵੱਧ ਉਪਾਅ ਉਠਾਉਣੇ ਚਾਹੀਦੇ ਹਨ ਸਾਨੂੰ ਖਰਚਾ ਘੱਟ ਤੋਂ ਘੱਟ ਕਰਨਾ ਚਾਹੀਦਾ ਹਨ ਅਤੇ ਸਾਨੂੰ ਵਰ ਜਿ ਕਿੱਥੇ ਪੈਸਾ ਵਰਤਣਾ ਚਾਹੀਦਾ ਹਨ ਜਿੱਥੇ ਲੋੜੀਂਦੀ ਸਮਗਰੀ ਹੋਵੇ ਸਾਨੂੰ ਬੇਫਾਲਤੂ ਖਰਚਾ ਨਹੀਂ ਕਰਨਾ ਚਾਹੀਦਾ ਹਨ ਜਿਸ ਦੇ ਵਜੋਂ ਇਹ ਖਾ ਇਹ ਖਾਤਾ ਬਣਾਉਣ ਲਈ ਇਸ ਦੇ ਉਦੇਸ਼ ਹਨ ਕਿ ਬੱਚਿਆਂ ਨੂੰ ਖ ਖਰਚਾ ਘੱਟ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਲਈ ਸਾਨੂੰ ਬੱਚਤ ਖਾਤਾ ਬਣਾਉਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਜਿਸ ਦੇ ਵਜੋਂ ਕਿ ਉਹ ਸਹੀ ਪੈਸੇ ਨੂੰ ਅਤੇ ਸਹੀ ਰਸੋਰਸ ਨੂੰ ਐਲੋਕੇਟ ਕਰਨਾ ਜਾਣਨਗੇ ਇਸ ਲਈ ਸਾਨੂੰ ਬੱਚਿਆਂ ਨੂੰ ਬੱਚਤ ਖਾਤਾ ਬਣਾਉਣ ਲਈ ਉਤਸਾਹਿਤ ਕਰਨ ਦੀ ਜ਼ਰੂਰਤ ਹੈ